ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਬੋਲ ਰਿਹਾਂ ਮੈਂ ਹੁਣੇ ਅੱਧੇ ਘੰਟੇ ਪਹਿਲੇ ਤੁਹਾਡੇ ਰੈਸਟੋਰੈਂਟ ਤੋਂ ਇੱਕ ਤਵਾ ਚਿਕਨ ਦਾ ਔਡਰ ਮੰਗਾਇਆ ਸੀ ਅਤੇ ਜਿਸ ਨਾਂ ਦੋ ਰੋਟੀਆਂ ਮੰਗਾਈਆਂ ਸੀ ਅਤੇ ਇਹ ਔਡਰ ਹੁਣ ਮੈਨੂੰ ਪ੍ਰਾਪਤ ਹੋਇਆ ਹੈ ਜਿਸ ਵਿੱਚ ਕਿ ਬਹੁਤ ਜ਼ਿਆਦਾ ਮਸਾਲਾ ਹੈ ਅਤੇ ਇਹ ਮੈਨੂੰ ਖਾਣ ਵਿੱਚ ਵੀ ਬਹੁਤ ਜ਼ਿਆਦਾ ਬਾਸਾ ਲੱਗ ਰਿਹਾ ਅਤੇ ਰੋਟੀਆਂ ਵੀ ਬਹੁਤ ਜ਼ਿਆਦਾ ਸਖਤ ਹਨ ਜਿਸ ਕਾਰਨ ਮੈਨੂੰ ਤੁਹਾਡਾ ਭੇਜਿਆ ਹੋਇਆ ਖਾਣੇ ਤੋਂ ਮੈਂ ਸੰਤੁਸ਼ਟ ਨਹੀਂ ਹਾਂ ਕਿਰਪਾ ਕਰਕੇ ਆਪਣੇ ਇਸ ਔਡਰ ਨੂੰ ਵਾਪਸ ਕਰ ਲਓ ਅਤੇ ਮੇਰਾ ਮੈਨੂੰ ਬਣਦਾ ਰਿਫੰਡ ਦਿੱਤਾ ਜਾਵੇ